ਪਿਛਲੇ ਕੁਝ ਦਿਨ ਪਹਿਲਾਂ ਮੈਂ ਇੱਕ ਵੋਚ ਖਰੀਦਣਾ ਚਾਹੁੰਦਾ ਸੀ ਇਸ ਲਈ ਮੈਂ ਐਮਾਜ਼ੋਨ ਜੋ ਕਿ ਔਨਲਾਈਨ ਸ਼ਾਪਿੰਗ ਵੈਬਸਾਈਟ ਹੈ ਅਤੇ ਬਹੁਤ ਪਾਪੂਲਰ ਸਾਈਟ ਹੈ ਇੱਥੇ ਸਾਰੇ ਹੀ ਸ਼ੋਪਿੰਗ ਕਰਦੇ ਹਨ ਅਤੇ ਬਹੁਤ ਵਧੀਆ ਕੁਆਲਿਟੀ ਦੇ ਪ੍ਰੋਡਕਟ ਵੀ ਇੱਥੇ ਮਿਲਦੇ ਹਨ ਉੱਥੇ ਬੋਟ ਕੰਪਨੀ ਦੀ ਸਮਾਰਟ ਵੋਚਿਸ ਨੂੰ ਐਕਸਪਲੋਰ ਕਰਨ ਲੱਗਾ ਤਾਂ ਮੈਂ ਦੇਖਿਆ ਕਿ ਇੱਥੇ ਬਹੁਤ ਸਾਰੀਆਂ ਵਰਾਇਟੀਜ ਪ੍ਰੈਜੈਂਟ ਸੀ ਅਤੇ ਸਾਰੀਆਂ ਵੋਚਿਸ ਨਿਊ ਲੌਂਚ ਹੋਈਆਂ ਸਨ ਮੈਨੂੰ ਸਾਰੀਆਂ ਵੋਚਿਸ ਬਹੁਤ ਪਸੰਦ ਆ ਰਹੀਆਂ ਸੀ ਬਹੁਤ ਟਾਈਮ ਬਾਅਦ ਮੈਂ ਇੱਕ ਬੋਟ ਕੰਪਨੀ ਦੀ ਵੋਚ ਜੋ ਕਿ ਹਾਲਾਂਕਿ ਹੀ ਲੌਂਚ ਹੋਈ ਸੀ ਇਹ ਵੋਚ ਮੈਨੂੰ ਬਹੁਤ ਪਸੰਦ ਲੱਗੀ ਇਸ ਦਾ ਕਲਰ ਕੋਂਬੀਨੇਸ਼ਨ ਵੀ ਬਹੁਤ ਵਧੀਆ ਸੀ ਇਹ ਬਿਲਕੁਲ ਐਪਲ ਵੋਚ ਦੀ ਤਰ੍ਹਾਂ ਹੀ ਦਿੱਖਦੀ ਸੀ ਇਸ ਦੇ ਨਾਲ ਬਲੈਕ ਅਤੇ ਔਰੇਂਜ ਕਲਰ ਦਾ ਚੇਨ ਵੀ ਫਰੀ ਮਿਲ ਰਹੀ ਸੀ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਅਤੇ ਉਹ ਘੜੀ ਦਾ ਪ੍ਰਾਈਜ ਸਿਰਫ ਚਾਰ ਹਜ਼ਾਰ ਰੁਪਈਏ ਸੀ ਇਸ ਦਾ ਚਾਰਜਰ ਬਹੁਤ ਸਮਾਰਟ ਅਤੇ ਫਾਸਟ ਚਾਰਜਿੰਗ ਵਾਲਾ ਸੀ ਇਸ ਘੜੀ ਵਿੱਚ ਐਕਸਟਰਾ ਫੀਚਰ ਵੀ ਸਨ ਅਤੇ ਕੈਮਰਾ ਕੁਆਲਿਟੀ ਬਹੁਤ ਵਧੀਆ ਸੀ ਇਸ ਦਾ ਸਾਊਂਡ ਸਿਸਟਮ ਬਹੁਤ ਵਧੀਆ ਅਤੇ ਕਲੀਅਰ ਸੀ ਅਤੇ ਫਿਰ ਮੈਂ ਉਸ ਨੂੰ ਔਡਰ ਕਰ ਦਿੱਤਾ ਬਹੁਤ ਹੀ ਜਲਦੀ ਮੈਨੂੰ ਇਸਦੀ ਡਿਲੀਵਰੀ ਪ੍ਰਾਪਤ ਹੋਈ ਅਤੇ ਜਦੋਂ ਮੈਂ ਉਸ ਪ੍ਰੋਡਕਟ ਦੀ ਡਿਲੀਵਰੀ ਨੂੰ ਅਸੈਪਟ ਕੀਤਾ ਤਾਂ ਉਸਦੇ ਉੱਪਰ ਬਹੁਤ ਹੀ ਐਕਸੀਲੈਂਟ ਤਰੀਕੇ ਨਾਲ ਰੈਪ ਅਤੇ ਪੈਕ ਕੀਤਾ ਗਿਆ ਸੀ ਜੋ ਕਿ ਮੈਨੂੰ ਦੇਖਣ 'ਤੇ ਹੀ ਬਹੁਤ ਪਸੰਦ ਲੱਗਿਆ ਮੈਨੂੰ ਔਨਲਾਈਨ ਸ਼ੋਪਿੰਗ ਕਰਕੇ ਬਹੁਤ ਹੀ ਪੋਜ਼ੀਟਿਵ ਐਕਸਪੀਰੀਅੰਸ ਹੋਇਆ ਮੈਂ ਬਹੁਤ ਖੁਸ਼ ਹਾਂ ਕਿ ਜਿੱਦਾਂ ਦਾ ਪ੍ਰੋਡਕਟ ਮੈਨੂੰ ਚਾਹੀਦਾ ਸੀ ਉੱਦਾਂ ਦਾ ਪ੍ਰੋਡਕਟ ਹੀ ਮੈਨੂੰ ਹਾਸਲ ਹੋਇਆ ਉਹ ਘੜੀ ਮੇਰੇ ਆਉਣ ਵਾਲੇ ਸਮੇਂ ਵਿੱਚ ਮੇਰੀ ਬਹੁਤ ਹੈਲਪ ਕਰੇਗੀ ਮੈਨੂੰ ਔਨਲਾਈਨ ਸ਼ੌਪਿੰਗ ਕਰਕੇ ਬਹੁਤ ਵਧੀਆ ਅਤੇ ਬਹੁਤ ਹੀ ਚੰਗਾ ਐਕਸਪੀਰੀਅੰਸ ਮਿਲਿਆ